ਮੈਂ ਆਪਣੀ ਜ਼ਿੰਦਗੀ ਵਿੱਚ ਸਭ ਤੋਂ ਵੱਧ ਕਦਰ ਸਮੇਂ ਦੀ ਕਰਦੀ ਹਾਂ ਕਿਉਂਕਿ ਕਿਸੇ ਚੰਗੀ ਚੀਜ਼ ਲਈ ਕੱਢਿਆ ਗਿਆ ਸਮਾਂ ਸਾਡੀ ਜ਼ਿੰਦਗੀ ਦੀ ਨੁਹਾਰ ਨੂੰ ਬਦਲ ਸਕਦਾ ਹੈ